ਹਾਂ ਮੈਂ ਇੱਕ ਅਕਾਸ਼ੀ ਘਟਨਾ ਦੇਖੀ ਆ ਇੱਕ ਵਾਰ ਕੀ ਹੋਇਆ ਸੀ ਕਿ ਸੂਰਜ ਨੂੰ ਗ੍ਰਹਿਣ ਲੱਗ ਰਿਹਾ ਸੀ ਜਦੋਂ ਸੂਰਜ ਨੂੰ ਹੌਲੀ ਕਰਕੇ ਬਾਰ੍ਹਾਂ ਵਜੇ ਦਾ ਟਾਈਮ ਸੀ ਸੂਰਜ ਨੂੰ ਹੌਲੀ ਕਰਕੇ ਜਦੋਂ ਗ੍ਰਹਿਣ ਲੱਗਣਾ ਸ਼ੁਰੂ ਹੋਇਆ ਤਾਂ ਥੋੜ੍ਹੀ ਥੋੜ੍ਹੀ ਜਦੋਂ ਧੁੱਪ ਆ ਉਹ ਘਟਣੀ ਸ਼ੁਰੂ ਹੋ ਗਈ ਜਦੋਂ ਗ੍ਰਹਿਣ ਲੱਗਣਾ ਜਦੋਂ ਪੂਰੀ ਤਰ੍ਹਾਂ ਗ੍ਰਹਿਣ ਲੱਗ ਗਿਆ ਅਤੇ ਜਿਹੜੀ ਧੁੱਪ ਆ ਉਹ ਬਿਲਕੁਲ ਹੀ ਬੰਦ ਹੋ ਗਈ ਅਤੇ ਮਤਲਬ ਦਿਨ ਵਿੱਚ ਹੀ ਹਲਕਾ ਹਲਕਾ ਮੈਨੂੰ ਜਿਹੜਾ ਹਨੇਰਾ ਨਾ ਉਹ ਪ੍ਰਤੀਤ ਹੋਣਾ ਸ਼ੁਰੂ ਹੋਇਆ ਸੀ